ਭਾਰ ਵਧਾਉਣ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਸਿਹਤਮੰਦ ਹੋਣਾ ਹੈ ਨਾ ਕਿ ਮੋਟੇ ਹੋਣਾ ਹੈ ਭਾਰ ਵਧਾਉਣ ਲਈ ਸਭ ਤੋਂ ਵਧੀਆ ਤਰੀਕਾ ਇਹ ਹੀ ਹੈ ਕਿ ਸਾਨੂੰ ਕੈਲਰੀ ਪੋਸ਼ਕ ਤੱਤ ਅਤੇ ਪ੍ਰੋਟੀਨ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਸੁੱਕੇ ਮੇਵੇ ਬਦਾਮ ਕਿਸ਼ਮਿਸ਼ 'ਚ ਕਾਫੀ ਮਾਤਰਾ 'ਚ ਕਲੇ ਕੈਲੋਰੀ ਕੈਲਰੀ ਹੁੰਦੀ ਹੈ ਅਤੇ ਇਹਨਾਂ ਨਾਲ ਭਾਰ ਵੀ ਸਹੀ ਤਰੀਕੇ ਨਾਲ ਵੱਧਦਾ ਹੈ ਭਰਪੂਰ ਪੋਸ਼ਕ ਤੱਤ ਵਾਲਾ ਭੋਜਨ ਖਾਣਾ ਚਾਹੀਦਾ ਹੈ ਜੋ ਤੁਹਾਨੂੰ ਊਰਜਾ ਦੇਵੇ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਇਸ ਵਿੱਚ ਯੋਗਾ ਵੀ ਸ਼ਾਮਿਲ ਕਰ ਸਕਦੇ ਹਾਂ ਆਪਣੇ ਭੋਜਨ ਵਿੱਚ ਮੱਖਣ ਪਨੀਰ ਘਿਓ ਸ਼ਾਮਿਲ ਕਰਨਾ ਚਾਹੀਦਾ ਹੈ ਰੋਜ਼ ਸਵੇਰੇ ਅਤੇ ਸ਼ਾਮ ਸੈਰ ਕਰਨੀ ਚਾਹੀਦੀ ਹੈ ਪ੍ਰੋਟੀਨ ਸ਼ ਪ੍ਰੋਟੀਨ ਸ਼ੇਕ ਅਤੇ ਪ੍ਰੋਟੀਨ ਵਾਲਾ ਭੋਜਨ ਮਾ ਖਾਣਾ ਚਾਹੀਦਾ ਹੈ ਜਿਵੇਂ ਮਾਸ ਮੱਛੀ ਆਂਡਾ ਆਦਿ ਹਰੀਆਂ ਸਬਜ਼ੀਆਂ ਨਾਲ ਬਿਨਾਂ ਕਿਸੇ ਤਣਾਅ ਦੇ ਭਾਰ ਵਧਾਇਆ ਜਾ ਸਕਦਾ ਹੈ ਦਿਨ ਵਿੱਚ ਘੱਟੋ ਘੱਟ ਅੱਠ ਘੰਟੇ ਦੀ ਭਰਪੂਰ ਨੀਂਦ ਲੈਣੀ ਚਾਹੀਦੀ ਹੈ